ਹੈਲੋ ਮੇਰਾ ਨਾਂ ਜਸ਼ਨਪ੍ਰੀਤ ਸਿੰਘ ਹੈ ਕੀ ਤੁਸੀਂ ਐਮਾਜੋਨ ਕਸਟਮਰ ਕੇਅਰ ਤੋਂ ਗੱਲ ਕਰ ਰਹੇ ਹੋ ਮੈਂ ਅੱਜ ਤੋਂ ਦਸ ਦਿਨ ਪਹਿਲਾਂ ਇੱਕ ਨਾਵਲ ਆਡਰ ਕਰਿਆ ਸੀਗਾ ਐਮਾਜੋਨ ਤੋਂ ਜਿਹੜਾ ਕਿ ਮੈਨੂੰ ਬਜਾ ਬਜ਼ਾਰ ਚੋਂ ਮਿਲਿਆ ਨਹੀਂ ਸੀਗਾ ਮੈਨੂੰ ਆਡਰ ਕਰੇ ਨੂੰ ਅੱਠ ਦਿਨ ਹੋ ਗਏ ਸੀ ਕਿ ਜਿਹੜਾ ਕਿ ਮੇਰਾ ਨਾਵਲ ਪੰਦਰਾਂ ਦਿਨਾਂ ਤੋਂ ਆਇਆ ਅਤੇ ਉਸਦੀ ਪੈਕਿੰਗ ਵੀ ਕੋਈ ਬਹੁਤ ਅੱਛੀ ਨਹੀਂ ਸੀਗੀ ਅਤੇ ਮੈਂ ਤੁਹਾਡੇ ਤੋਂ ਬਹੁਤ ਹੀ ਨਰਾਜ਼ ਹਾਂ ਕਿਉਂਕਿ ਜਿਹੜਾ ਮੈਂ ਪਾਰਟ ਵਨ ਮੰਗਵਾਇਆ ਸੀ ਨਾਵਲ ਦਾ ਅਤੇ ਮੈਨੂੰ ਪਾਰਟ ਸੈਕੰਡ ਦਿੱਤਾ ਗਾ ਦੂਜਾ ਪਾਰਟ ਦਿੱਤਾ ਗਾ ਨਾਵਲ ਦਾ ਅਤੇ ਮੈਨੂੰ ਕੋਈ ਬਹੁਤਾ ਚੰਗਾ ਨਹੀਂ ਲੱਗਿਆ ਅਤੇ ਨਾਵਲ ਦੇ ਵਿੱਚੋਂ ਪੇਜ ਵੀ ਅੱਧੇ ਪਾਟੇ ਹੋਏ ਸਨ ਕੋਈ ਬਹੁਤਾ ਚੰਗਾ ਡਿਲਿਵਰੀ ਨਹੀਂ ਸੀਗੀ ਤੁਹਾਡੀ ਐਮਾਜੋਨ ਦੀ ਅਤੇ ਮੈਂ ਬਹੁਤ ਹੀ ਜ਼ਿਆਦਾ ਨਰਾਜ਼ ਹਾਂ ਤੁਹਾਡੇ ਤੋਂ ਅੱਗੇ ਤੋਂ ਮੈਂ ਕੋਈ ਵੀ ਐਮਾਜੋਨ ਤੋਂ ਡਿਲੀਵਰੀ ਨਹੀਂ ਕਰਦਾ ਉੱਤੋਂ ਕੇ ਮੇਰੇ ਤੋਂ ਤੁਸੀਂ ਫੀਸ ਵੀ ਵੱਧ ਲਈ ਇਸ ਵਿੱਚ ਐਮਾਜੋਨ ਐਮਾਜੋਨ ਦੀ ਹੀ ਜ਼ਿਆਦਾ ਗਲਤੀ ਹੈ ਕਿਉਂਕਿ ਉਹਨਾਂ ਨੇ ਕੁਛ ਪੈਕਿੰਗ ਵੀ ਨਹੀਂ ਅੱਛੀ ਕੀਤੀ ਹੋਈ ਸੀਗੀ ਪੈਕਿੰਗ ਵੀ ਬਹੁਤ ਬੁਰੀ ਸੀਗੀ